ਮੈਂ ਆਪਣੀ ਚਿੱਤਰਕਾਰੀ ਦੀ ਸ਼ੁਰੂਆਤ ਛੋਟੀ ਉਮਰ ਤੋਂ ਹੀ ਕਰ ਦਿੱਤੀ ਸੀ ਮੈਨੂੰ ਇਸ ਕੰਮ ਵਿੱਚ ਬਹੁਤ ਦਿਲਚਸਪੀ ਸੀ ਅਤੇ ਇਸ ਦਾ ਮੈਨੂੰ ਬਹੁਤ ਸ਼ੌਂਕ ਸੀ ਸਭ ਤੋਂ ਪਹਿਲਾਂ ਮੈਂ ਕਿਸੇ ਦੁਆਰਾ ਬਣਾਈ ਹੋਈ ਇੱਕ ਕੁਦਰਤ ਦੀ ਪੇਂਟਿੰਗ ਦੇਖੀ ਜਿਸ ਨੂੰ ਦੇਖ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਨੂੰ ਵੀ ਇਹ ਚਿੱਤਰਕਾਰੀ ਕਰਨੀ ਚਾਹੀਦੀ ਹੈ ਅਤੇ ਹੌਲੀ ਹੌਲੀ ਕਰਕੇ ਮੇਰਾ ਇਹਨਾਂ ਕੰਮਾਂ ਵਿੱਚ ਸ਼ੌਂਕ ਪੈ ਗਿਆ ਇਸ ਤਰ੍ਹਾਂ ਮੈਨੂੰ ਕੁਦਰਤ ਨਾਲ ਸੰਬੰਧਿਤ ਬਹੁਤ ਸਾਰੇ ਚਿੱਤਰ ਬਣਾਉਣ ਦਾ ਸ਼ੌਂਕ ਹੈ ਮੇਰਾ ਮਨਪਸੰਦ ਕਲਾਕਾਰ ਅਨਿਲ ਗਲੋਤਰਾ ਹੈ